ਹਾਂ ਭੰਗੜੇ ਦੀ ਮਹੱਤਤਾ ਮੈਂ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਦੱਸ ਸਕਦਾ ਹਾਂ ਜਿਵੇਂ ਕਿ ਭੰਗੜਾ ਹੈ ਜਿਹੜਾ ਆਪਣਾ ਪ੍ਰਸਿੱਧ ਲੋਕ ਨਾਚ ਹੈ ਪੰਜਾਬੀਆਂ ਦਾ ਖ਼ਾਸ ਕਰਕੇ ਭੰਗੜੇ ਦੀ ਮਹੱਤਤਾ ਬਹੁਤ ਹੀ ਜ਼ਿਆਦਾ ਹੈ ਪੰਜਾਬੀਆਂ ਦੇ ਦਿਲਾਂ ਵਿੱਚ ਅਸਲ ਮੇਂ ਬਾਅਦ ਵਿੱਚ ਇਹਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ ਜਦੋਂ ਅਸੀਂ ਇਸ ਨੂੰ ਹੋਰ ਕੰਟਰੀਆਂ ਦੁਆਰਾ ਦੇਖਦੇ ਹਾਂ ਵੀ ਹੋਰ ਕੰਟਰੀਆਂ ਵੀ ਭੰਗੜਾ ਪਾਉਂਦੀਆਂ ਹਨ ਜਾਂ ਉੱਥੇ ਇਹਨਾਂ ਇਹੋ ਜਿਹੇ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾਂਦੇ ਹਨ ਭੰਗੜੇ ਦੀ ਪ੍ਰਵਿਰਤੀ ਹੈ ਜਿਹੜੀ ਉਹ ਸ਼ੁਰੂ ਸ਼ੁਰੂ ਤੋਂ ਹੀ ਸ਼ੁਰੂਆਤ ਮੰਨੀ ਜਾਂਦੀ ਹੈ ਭੰਗੜਾ ਪੰਜਾਬੀਆਂ ਲਈ ਇੱਕ ਤਰ੍ਹਾਂ ਦੀ ਇਹ ਨਾਚ ਨਹੀਂ ਹੈ ਇਹ ਉਹਨਾਂ ਦੇ ਹਾਵ ਭਾਵ ਮਨੋਬਿਰਤੀਆਂ ਨੇ ਜਿਹਨਾਂ ਨਾਲ ਉਹ ਆਪਣੀ ਖੁਸ਼ੀ ਦਾ ਪ੍ਰਗਟਾਵਾ ਜਾਹਿਰ ਕਰਦੇ ਨੇ ਅਤੇ ਹੋਰ ਵੀ ਬਹੁਤ ਸਾਰੇ ਆਪਣਾ ਅ ਮਨੋਰੰਜਨ ਦਾ ਇੱਕ ਸਾਧਨ ਕਹਿ ਸਕਦੇ ਹਾਂ ਪਰ ਇਹ ਦੁਨੀਆ ਭਰ ਵਿੱਚ ਇਹ ਪੰਜਾਬ 'ਚ ਤਾਂ ਪ੍ਰਚਲਿਤ ਹੈ ਹੀ ਹੈ ਇਹ ਦੁਨੀਆ ਭਰ ਵਿੱਚ ਵੀ ਪੂਰਾ ਬਹੁਤ ਵਿਸ਼ਵ ਪੱਧਰ 'ਤੇ ਪ੍ਰਚਲਿਤ ਹੈ ਅੱਜ ਕੱਲ੍ਹ ਆਪਾਂ ਡੇਲੀ ਨਿਊਜ਼ ਦੇਖਦੇ ਹਾਂ ਖ਼ਬਰਾਂ ਪੜ੍ਹਦੇ ਹਾਂ ਟੀ ਵੀ ਟੈਲੀਵਿਜ਼ਨ ਅਤੇ ਮੋਬਾਇਲ 'ਤੇ ਭੰਗੜੇ ਨੇ ਇੱਕ ਅਨੋਖੀ ਉੱਨਤੀ ਕੀਤੀ ਹੈ